ਹੈਲੋ ਹਾਂਜੀ ਹਾਂਜੀ ਬਠਿੰਡਾ ਥਾਣੇ 'ਚੋਂ ਥਾਣੇਦਾਰ ਅਜੀਤ ਸਿੰਘ ਗੱਲ ਕਰ ਰਿਹਾ ਜੀ ਅੱਛਾ ਅੱਛਾ ਜੀ ਵੈਸੇ ਤੁਸੀਂ ਕੌਣ ਗੱਲ ਕਰ ਰਹੇ ਹੋ ਜਨਾਬ ਅੱਛਾ ਅੱਛਾ ਅੱਛਾ ਅੱਛਾ ਪੱਤਰਕਾਰ ਠੀਕ ਆ ਠੀਕ ਆ ਸਰ ਜੀ ਹਾਂਜੀ ਹਾਂਜੀ ਜੀ ਹਾਂਜੀ ਪੱਤਰਕਾਰ ਸਾਹਿਬ ਜੀ ਗੱਲ ਇੱਦਾਂ ਗੀ ਅਸੀਂ ਆਪਣੇ ਵੱਲੋਂ ਪੂਰੀ ਜਾਰੀ ਕੋਸ਼ਿਸ਼ ਜਾਰੀ ਕਰ ਰਹੇ ਹਾਂ ਠੀਕ ਆ ਸਾਡਾ ਸਟਾਫ ਦਿਨ ਵਿੱਚ ਅ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਹੈਗਾ ਵਧੀਆ ਦੁਕਾਨਾਂ 'ਤੇ ਪ ਪਾਬੰਦੀ ਲਗਾ ਰੱਖੀ ਹੈ ਨਸ਼ਿਆਂ ਦੀ ਡਰੱਗਸ ਦੀ ਪੂਰੀ ਰੋਕ ਲਈ ਬਾਕੀ ਨਸ਼ੇੜੀਆਂ ਨੂੰ ਚੱਕ ਰਹੇ ਹਾਂ ਅਸੀਂ ਪ੍ਰੋਪਰ ਇਹੀ ਹੈ ਜੀ ਬਾਕੀ ਇਹ ਆ ਸਰ ਕੋਈ ਵੀ ਨਸ਼ੇ ਦੀ ਕਿਸੇ ਦਾ ਹੈ ਨਾ ਕੋਈ ਕੰਮ ਖ਼ਰਾਬ ਨਾ ਹੋਵੇ ਜਾਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਬੱਚੇ ਕੀ ਆ ਜਦੋਂ ਨਸ਼ੇ ਕਰਦੇ ਆ ਤਾਂ ਠੱਗੀਆਂ ਚੋਰੀਆਂ ਵੀ ਕਰਦੇ ਆ ਬਾਕੀ ਸ਼ਹਿਰ ਦੀ ਜਨਤਾ ਨੂੰ ਉਹ ਰਹਿੰਦਾ ਅਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਰੋਕਥਾਮ ਕਰ ਰਹੇ ਹਾਂ ਆਪਣੇ ਵੱਲੋਂ ਹਾਂਜੀ ਹਾਂਜੀ ਹਾਂਜੀ ਤੁਸੀਂ ਵੈਸੇ ਕਿਹੜੇ ਆਪਣੇ ਅਖਬਾਰ ਦੇ ਪੱਤਰਕਾਰ ਹੋ ਜੀ ਅਜੀਤ ਅਖਬਾਰ ਦੇ ਠੀਕ ਆ ਠੀਕ ਆ ਜੀ ਕੋਈ ਗੱਲ ਨਹੀਂ ਸਰ ਦੱਸੋ ਜੀ ਜਦੋਂ ਵੀ ਕੋਈ ਸੇਵਾ ਦਾ ਮੌਕਾ ਮਿਲਦਾ ਸਾਨੂੰ ਸੇਵਾ ਦ ਜ਼ਰੂਰ ਦਿਓ ਜੀ ਬਾਕੀ ਬਠਿੰਡਾ ਬਠਿੰਡਾ ਪੰਜਾਬ ਪੁਲਿਸ ਥਾਣਾ ਕੈਂਟ ਤੋਂ ਤੁਹਾਡੀ ਹਾਜ਼ਰ ਸੇਵਾ ਦੇ ਵਿੱਚ ਹਾਜ਼ਰ ਆ ਚੌਵੀ ਘੰਟੇ ਸਾਡਾ ਇੱਕ ਟੋਲ ਫਰੀ ਨੰਬਰ ਵੀ ਹੈਗਾ ਜੀ ਹਾਂਜੀ ਹਾਂਜੀ ਲੇਡੀਜ ਵੂਮੈਨ ਲਈ ਹੈਲਪ ਲੈਨ ਨੰਬਰ ਜੀਰੋ ਇੱਕ ਇੱਕ ਹਜ਼ਾਰ ਸਤਾਹਠ ਨੰਬਰ ਹਾਂਜੀ ਚੌਵੀ ਘੰਟੇ ਤੁਹਾਨੂੰ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਜੀ ਬਾਕੀ ਨਸ਼ਿਆਂ ਨੂੰ ਲੈ ਕੇ ਸੁਚੇਤ ਆ ਜੀ ਡਰੱਗ ਸਪਲਾਇਰਾਂ ਨੂੰ ਪ੍ਰੋਪਰ ਕੁੱਲ ਆ ਹੀ ਆ ਜੀ ਕਿ ਉਹਦੀ ਬਾਊਂਡਰੀ 'ਤੇ ਰੋਕ ਲਗਾ ਗਈ ਹੈ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਗੱਡੀਆਂ ਹਾਂਜੀ ਬਕਾਇਦਾ ਚੈਕਿੰਗ ਹੋ ਰਹੀ ਹੈ ਜੀ ਆਪਣੇ ਵੱਲੋਂ ਇਹੀ ਧਿਆਨ ਕਰ ਰਹੇ ਹਾਂ ਜੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਨਸ਼ੇ ਦੀ ਵੱਧ ਤੋਂ ਵੱਧ ਰੋਕਥਾਮ ਕਰ ਸਕੀਏ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਵੀਰੇ ਠੀਕ ਆ ਠੀਕ ਆ ਠੀਕ ਆ ਪੱਤਰਕਾਰ ਸਾਹਿਬ ਜੀ ਜੇ ਕੋਈ ਸੇਵਾ